ਹੈਲੋ ਤੁਸੀਂ ਨਵਦੀਪ ਸਿੰਘ ਬੋਲ ਰਹੇ ਹੋ ਓਲਾ ਕੰਪਨੀ ਤੋਂ ਮੇਰਾ ਨਾਮ ਮਨੀਸ਼ਾ ਹੈ ਮੈਨੂੰ ਤੁਹਾਡਾ ਨੰਬਰ ਓਲਾ ਕੰਪਨੀ ਵਾਲਿਆਂ ਨੇ ਦਿੱਤਾ ਸੀਗਾ ਮੈਂ ਐਕਚੁਲੀ ਕਾਰ ਬੁੱਕ ਕਰਵਾਣੀ ਸੀਗੀ ਮੈਂ ਕੱਲ੍ਹ ਚੰਡੀਗੜ੍ਹ ਜਾਣਾ ਚਾਹੁੰਦੀ ਹਾਂ ਮੈਂ ਅਤੇ ਮੇਰੀ ਫਰੈਂਡ ਅਸੀਂ ਦੋ ਪਰਸਨ ਹੋਵਾਂਗੇ ਇਸ ਲਈ ਸਾਨੂੰ ਸਮੌਲ ਕਾਰ ਹੀ ਚਾਹੀਦੀ ਹੈ ਵੈਸੇ ਤਾਂ ਅਸੀਂ ਪਿਕ ਅਪ ਟਾਈਮ ਸਾਡੇ ਨੌ ਦਾ ਦਿੱਤਾ ਸੀਗਾ ਬਟ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ੍ਹ ਬਹੁਤ ਧੁੰਦ ਦਾ ਟਾਈਮ ਹੈ ਬਹੁਤ ਜ਼ਿਆਦਾ ਹੀ ਹੋ ਰਹੀ ਹੈ ਜਿਸ ਦੇ ਕਾਰਨ ਗੱਡੀਆਂ ਥੋੜ੍ਹੀ ਸਲੋਅ ਹੀ ਚੱਲਣਗੀਆਂ ਅਤੇ ਅਸੀਂ ਉੱਥੇ ਟਾਈਮ ਸਿਰ ਪਹੁੰਚਣਾ ਚਾਹੁੰਦੇ ਹਾਂ ਇਸ ਕਰਕੇ ਤੁਸੀਂ ਕੋਸ਼ਿਸ਼ ਕਰਿਓ ਕਿ ਤੁਸੀਂ ਸਾਡੇ ਕੋਲ ਸ ਨੌ ਵਜੇ ਤੱਕ ਹੀ ਪਹੁੰਚ ਜਾਓ ਮੇਰਾ ਅਡਰੈੱਸ ਜੋ ਹੈ ਉਹ ਆਈ ਕੇ ਜੇ ਗੁਜਰਾਲ ਪੀ ਟੀ ਯੂ ਦੇ ਸਾਹਮਣੇ ਹੀ ਘਰ ਹੈ ਜਦੋਂ ਤੁਸੀਂ ਜੀ ਐੱਨ ਡੀ ਯੂ ਤੋਂ ਅੱਗੇ ਆਉਗੇ ਤਾਂ ਉੱਥੇ ਪੁਰਾਣੇ ਝੂੰਗੀ ਤੋਂ ਤੁਸੀਂ ਟਰਨ ਕਰਨਾ ਹੈ ਅਤੇ ਸਿੱਧਾ ਆਕੇ ਲੈਫਟ ਟਰਨ ਕਰੋਗੇ ਤਾਂ ਉੱਥੇ ਹੀ ਆਈ ਕੇ ਜੇ ਗੁਜਰਾਲ ਪੀ ਟੀ ਯੂ ਜਿਹੜੀ ਯੂਨੀਵਰਸਿਟੀ ਹੈ ਅਤੇ ਉਸ ਯੂਨੀਵਰਸਿਟੀ ਦੇ ਸਾਹਮਣੇ ਵਾਲਾ ਘਰ ਹੀ ਸਾਡਾ ਘਰ ਹੈ ਤੁਸੀਂ ਓਥੋਂ ਸਾਨੂੰ ਨੌ ਵਜੇ ਪਿਕ ਕਰ ਲਿਓ ਥੈਂਕ ਯੂ